ਹੈਲੋ ਸਤਿ ਸ਼੍ਰੀ ਅਕਾਲ ਮੈਂ ਨਾ ਅਰੁਣਾ ਰਾਣੀ ਅਰੁਣਾ ਬੋਲ ਰਹੀ ਹਾਂ ਮੈਂ ਨਾ ਸਿਲਾਈ ਦਾ ਅਤੇ ਬੁਣਾਈ ਦਾ ਕੰਮ ਕਰਦੀ ਹਾਂ ਮੈਂ ਘਰ ਦਾ ਵੀ ਕਰਦੀ ਹਾਂ ਮੈਂ ਸਵੇਰੇ ਗਿਆਰਾਂ ਵਜੇ ਤੱਕ ਘਰ ਦਾ ਨਾਸ਼ਤਾ ਵਗੈਰਾ ਬਣਾ ਕੇ ਬੱਚਿਆਂ ਨੂੰ ਭੇਜ ਕੇ ਅਤੇ ਫਿਰ ਮੈਂ ਸਿਲਾਈ ਦਾ ਮਸ਼ੀਨ ਦਾ ਕਰਦੀ ਹਾਂ ਮਸ਼ੀਨ ਦਾ ਸੂਟ ਸਿਊਂਦੀ ਹਾਂ ਡਿਜ਼ਾਇਨ ਵਾਲੇ ਫਿਰ ਦੂਜੇ ਵੀ ਸਿਊਂਦੀ ਹਾਂ ਸਿੰਪਲ ਸੂਟ ਸਿੰਪਲ ਸਿੰਪਲ ਸੂਟ ਵੀ ਸਿਊਂਦੀ ਹਾਂ ਅਤੇ ਮੈਂ ਆਪਣੇ ਘਰ ਦੇ ਵਿੱਚ ਮਸ਼ੀਨਾਂ ਰੱਖੀ ਦੀਆਂ ਸਿਲਾਈ ਵਾਲੀ ਪੋਂਚਿਆ ਵਾਲੀ ਅਤੇ ਉਹ ਜਿਹੜੀ ਤਰਪਾਈ ਵਾਲੀ ਐਹ ਕਰਕੇ ਅਤੇ ਮੈਂ ਕਰਦੀ ਹਾਂ ਕੰਮ ਮੈਨੂੰ ਬਹੁਤ ਸ਼ੌਕ ਆ ਮੇਰੇ ਕਿੰਨਾ ਨੀ ਸੂਟਾਂ ਦੇ ਡਿਜ਼ਾਇਨ ਨੂੰ ਮੈਂ ਪਾਉਂਦੀ ਹਾਂ ਸਿੰਪਲ ਸੂਟ ਵੀ ਜਿਹੜੇ ਸਿਊਂਦੀ ਉਹ ਮੈਂ ਘੱਟ ਪੈਸੇ ਲੈ ਲੈਂਦੀ ਹਾਂ ਜਿਹੜੇ ਮੈਂ ਡਿਜਾਇਨ ਬਣਾ ਕੇ ਸਿਊਂਦੀ ਹਾਂ ਉਹ ਮੈਂ ਜ਼ਿਆਦਾ ਲੈਂਦੀ ਹਾਂ ਅਤੇ ਮੈਂ ਮੈਨੂੰ ਬਹੁਤ ਜ਼ਿਆਦਾ ਸ਼ੌਕ ਹੈ ਮੈਂ ਆਪਣੇ ਘਰ ਦੇ ਵਿੱਚ ਆਹ ਸਾਰਾ ਕਰਦੀ ਹਾਂ ਵੀ ਵਧੀਆ ਤਰ੍ਹਾਂ ਦੇ ਡਿਜ਼ਾਇਨ ਬਣਾ ਕੇ ਅਤੇ ਮੈਂ ਦਿੰਦੀ ਹਾਂ ਅਤੇ ਮੈਨੂੰ ਬਹੁਤ ਸ਼ੌਕ ਆ ਸਵੈਟਰ ਵੀ ਮੈਂ ਬਣਾਉਂਦੀ ਹਾਂ ਅਤੇ ਘ ਪੈਰਾਂ ਵਾਲੀ ਮਸ਼ੀਨ ਰੱਖੀ ਦੀ ਹੈ ਅਤੇ ਮੋਟਰ ਵਾਲੀ ਵੀ ਰੱਖੀ ਦੀ ਆ ਜਿਹੜੀ ਸਿਲਾਈ ਆਲੀ ਮੋਟਰ ਵਾਲੀ ਕਿੰਨਾ ਨੀ ਹੁੰਦੀ ਆ ਉਹ ਮੋਟਰ ਲਾ ਕੇ ਰੱਖੀ ਦੀ ਹੈ ਅਤੇ ਉਹ ਮੈਨੂੰ ਕਿੰਨਾ ਨੀ ਬਹੁਤ ਸ਼ੌਕ ਆ ਮੈਂ ਕਿੰਨਾ ਨੀ ਸਵੈਟਰ ਵੀ ਬਣਾਉਂਦੀ ਹਾਂ ਡਿਜਾਇਨ ਵਾਲੇ ਬਣਾ ਲੈਂਦੀ ਹਾਂ ਸਿੰਪਲ ਵੀ ਬਣਾ ਲੈਂਦੀ ਹਾਂ ਅਤੇ ਬਾਕੀ ਕਿੰਨਾ ਨੀ ਉਹ ਹੋਰ ਕਿੰਨਾ ਨੀ ਤਰ੍ਹਾਂ ਦੇ ਕ ਕਰ ਲੈਂਦੀ ਹਾਂ ਮੈਂ ਅਤੇ ਮੈਨੂੰ ਘਰ ਦਾ ਵੀ ਸਾਰਾ ਮੈਂ ਕੰਮ ਆਪੇ ਕਰਦੀ ਹਾਂ ਘਰ ਦਾ ਦੁਪਹਿਰ ਦਾ ਵੀ ਫਿਰ ਕਰਕੇ ਫਿਰ ਤਿੰਨ ਚਾਰ ਵਜੇ ਤਿੰਨ ਵਜੇ ਤੱਕ ਮੈਂ ਘਰ ਦਾ ਕਰਦੀ ਹਾਂ ਫਿਰ ਤਿੰਨ ਵਜੇ ਤੋਂ ਬਾਅਦ ਫਿਰ ਮੈਂ ਬੁਣਾਈ ਦਾ ਕਿੰਨਾ ਨੀ ਸ਼ੁਰੂ ਕਰ ਦਿੰਦੀ ਸਵੈਟਰ ਸਵੂਟਰ ਬਣਾਉਂਦੀ ਹਾਂ ਮੈਂ ਕਿੰਨਾ ਨੀ ਅਤੇ ਬਾਕੀ ਸਭ ਠੀਕ ਆ ਦੇਖੀ ਬੇਟਾ ਬੇਟਾ ਦੇਖੀ